ਸਤਿ ਸ਼੍ਰੀ ਅਕਾਲ ਜੀ ਛੱਬੀ ਅਗਸਤ ਨੂੰ ਮੇਰਾ ਬਰਡੇ ਹੈ ਅਤੇ ਮੈਂ ਕਾਫੀ ਉਤਸਕ ਹਾਂ ਆਪਣੇ ਬਰਡੇ ਨੂੰ ਲੈ ਕੇ ਅਤੇ ਮੈਂ ਆਪਣੇ ਬਰਡੇ ਲੇ ਬਰਡੇ 'ਤੇ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਜਾ ਰਿਹਾ ਹੈ ਜਿਸ ਵਿੱਚ ਕਾਫੀ ਸਾਰੀ ਬਹੁਤ ਸਾਰੀ ਐਕਟੀਵਿਟੀਜ਼ ਸ਼ਾਮਿਲ ਹੈ ਅਤੇ ਮੈਂ ਉਹਦੇ ਵਿੱਚ ਉਹਨਾਂ ਐਕਟੀਵਿਟੀ ਵਿੱਚ ਇੱਕ ਐਕਟੀਵਿਟੀ ਫਿਲਮ ਦੇਖਣੀ ਵੀ ਹੈ ਜਿਹੜੀ ਜਿਹੜੀ ਫਿਲਮ ਦਾ ਨਾਮ ਹੈ ਦਾਲੀਕੋਟਾ ਜਿਹੜੀ ਇੱਕ ਇਤਿਹਾਸਿਕ ਫਿਲਮ ਹੈ ਜਿਹੜੀ ਵਿਜੇ ਨਗਰ ਅੰਪਾਇਰ ਅਤੇ ਹਰੀ ਹਰੀ ਬੁੱਕਾ ਦੇ ਵਿੱਚ ਯੁੱਧ ਦੀ ਦੇ ਬਾਰੇ ਦਰਸਾਉਂਦੀ ਹੈ ਅਤੇ ਮੈਂ ਇਹ ਮੂਵੀ ਮੈਂ ਅਤੇ ਮੇਰਾ ਦੋਸਤ ਦੇ ਨਾਲ ਦੇਖਣ ਜਾ ਰਿਹਾ ਹੈ ਇਹ ਇਹ ਫਿਲਮ ਮੈਂ ਮੂਵੀ ਡੋਟ ਕੋਮ 'ਤੇ ਡੋਟ ਅ ਮੂਵੀ ਡੋਟ ਕੋਮ 'ਤੇ ਔਡਰ ਕਰੀ ਆ ਜਿਸਦੀ ਜਿਸਦੀ ਇੱਕ ਟਿਕਟ ਦਾ ਕੀ ਜਿਸਦੀ ਇੱਕ ਟਿਕਟ ਦੀ ਕੀਮਤ ਦੋ ਸੌ ਉਨੱਤੀ ਰੁਪਏ ਹੈ ਅਤੇ ਨਾਲ ਹੀ ਮੈਂ ਅਤੇ ਨਾਲ ਹੀ ਮੈਂ ਇਹਦੇ ਵਿੱਚ ਅ ਖਾਣ ਪੀਣ ਦੀ ਆਈਟਮਾਂ ਵੀ ਇੰਕਲੂਡ ਕਰਵਾਈ ਹੈ ਜਿਵੇਂ ਬਰਗਰ ਕੋਲਡ ਡ੍ਰਿੰਕ ਸੈਂਡਵਿਚ ਸੈਟਰਾ ਅਤੇ ਮੈਂ ਅਤੇ ਮੇਰਾ ਦੋਸਤ ਇਹ ਫਿਲਮ ਦੇਖਣ ਲਈ ਕਾਫੀ ਉਤਸਕ ਹਨ ਅਤੇ ਜਲਦੀ ਹੀ ਇਹ ਫਿਲਮ ਛੱਬੀ ਅਗਸਤ ਨੂੰ ਆਪਾਂ ਨਾਲ ਇਕੱਠੇ ਦੇਖਾਂਗੇ ਧੰਨਵਾਦ